ਹੁਣ ਤੱਕ ਦੀ ਸਭ ਤੋਂ ਸੁੰਦਰ ਯਾਤਰਾ ਜੋ ਮੈਂ ਕੀਤੀ ਹੈ ਉਹ ਕਸ਼ਮੀਰ ਦੀ ਹੈ ਅੱਜ ਤੋਂ ਦਸ ਸਾਲ ਪਹਿਲਾਂ ਵੀ ਮੈਂ ਕਸ਼ਮੀਰ ਗਈ ਸੀ ਅਤੇ ਹੁਣ ਹਫਤਾ ਪਹਿਲਾਂ ਵੀ ਮੈਂ ਕਸ਼ਮੀਰ ਗਈ ਸੀ ਅੱਜ ਤੋਂ ਦਸ ਸਾਲ ਪਹਿਲਾਂ ਜਦੋਂ ਮੈਂ ਕਸ਼ਮੀਰ ਗਈ ਸੀ ਉਦੋਂ ਤਾਂ ਅਸੀਂ ਬੇਤਾਬ ਵੈਲੀ ਪਹਿਲਗਾਉਂ ਸੋਨਮਰਗ ਗੁਲਮਰਗ ਸਭ ਜਗ੍ਹਾ 'ਤੇ ਘੁੰਮੇ ਸੀਗੇ ਗੁਲਮਰਗ 'ਤੇ ਬਹੁਤ ਜ਼ਿਆਦਾ ਬਰਫ ਸੀਗੀ ਅਸੀਂ ਉੱਥੇ ਬਹੁਤ ਟਰੈਕਿੰਗ ਕੀਤੀ ਇਹ ਹੋਇਆ ਕਿ ਮੇਰਾ ਬੇਟਾ ਤਾਂ ਉੱਥੇ ਸਕੀਈਂਗ ਕਰਦਾ ਕਰਦਾ ਬਿਲਕੁਲ ਟੋਪ 'ਤੇ ਚਲਾ ਗਿਆ ਵੀ ਉਹਨੂੰ ਮਤਲਬ ਕਿ ਜੇ ਮੈਂ ਨਾ ਧਿਆਨ ਰੱਖਦੀ ਤਾਂ ਉਹਨੇ ਦੂਜੇ ਪਾਸੇ ਹੀ ਚਲੇ ਜਾਣਾ ਸੀਗਾ ਜਿਹੜਾ ਕਿ ਪਾਕਿ ਕਸ਼ਮੀਰ ਹੈਗਾ ਅਤੇ ਜੋ ਕਿਸੇ ਤਰ੍ਹਾਂ ਉਹ ਬਚ ਗਿਆ ਪਰ ਅਸੀਂ ਉੱਥੇ ਆਪਣੀ ਟਰੈਕਿੰਗ ਨੂੰ ਬਹੁਤ ਹੀ ਸਕੀਈਂਗ ਕੀਤੀ ਉੱਥੇ ਬਹੁਤ ਮਜ਼ਾ ਆਇਆ ਸਾਨੂੰ ਅਤੇ ਫੇਰ ਅਸੀਂ ਉਸ ਤੋਂ ਬਾਅਦ ਸ਼ਾਮ ਨੂੰ ਜਿਸ ਤਰ੍ਹਾਂ ਡੱਲ ਲੇਕ 'ਤੇ ਸ਼ਿਕਾਰੇ 'ਤੇ ਗਏ ਸ਼ਿਕਾਰੇ 'ਤੇ ਅਸੀਂ ਸੂਰਜ ਡੁੱਬਦਾ ਵੇਖਿਆ ਜਦੋਂ ਅਸੀਂ ਸੂਰਜ ਡੁੱਬਦਾ ਵੇਖਿਆ ਐਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਸੂਰਜ ਡੱਬ ਡੁੱਬਦਾ ਹੋਇਆ ਲੇਕ ਦੇ ਵਿੱਚ ਹੀ ਵੜ ਰਿਹਾ ਹੈ ਇੱਕ ਵਾਰੀ ਅਸੀਂ ਸੂਰਜ ਦਾ ਚੜ੍ਹਨਾ ਦੇਖਿਆ ਪਹਿਲਗਾਉਂ ਉੱਥੇ ਸਾਨੂੰ ਪਹਾੜਾਂ ਦੇ ਵਿੱਚੋਂ ਨਿਕਲਦਾ ਸੂਰਜ ਦਿਖਿਆ ਅਤੇ ਇਹ ਲੱਗੇ ਕਿ ਪਹਾੜਾਂ ਦੇ ਵਿੱਚੋਂ ਨਿਕਲ ਕੇ ਸੂਰਜ ਬਾਹਰ ਆ ਰਿਹਾ ਹੈ ਤਾਂ ਇਸ ਤਰ੍ਹਾਂ ਕਰਕੇ ਅਸੀਂ ਸੂਰਜ ਦਾ ਚੜ੍ਹਨਾ ਅਤੇ ਸੂਰਜ ਦਾ ਡੁੱਬਣਾ ਮੈਨੂੰ ਬਹੁਤ ਹੀ ਚੰਗਾ ਲੱਗਿਆ ਅਤੇ ਮੈਨੂੰ ਹੁਣ ਵੀ ਬਹੁਤ ਯਾਦ ਆਉਂਦੀ